ਹੈਲੋ ਹਾਂਜੀ ਕੌਣ ਬੋਲ ਰਹੇ ਹੋ ਕੰਪਿਊਟਰ ਅੱਛਾ ਮਤਲਬ ਐਲ ਈ ਡੀ ਦੀ ਕਿਵੇਂ ਅੱਛਾ ਨਹੀਂ ਐਂ ਨਹੀਂ ਜਦੋਂ ਤੁਸੀਂ ਆਨ ਕਰਦੇ ਹੋ ਮੰਨ ਲਓ ਤੁਸੀਂ ਆਨ ਕਰਦੇ ਹੋ ਸਕਰੀਨ ਨੂੰ ਹੈ ਨਾ ਤਾਂ ਉਹ ਮਤਲਬ ਸਾਰੀ ਕਾਲੀ ਹੋ ਰਹੀ ਹੈ ਜਾਂ ਕੁਛ ਪਾਰਟ ਕਾਲਾ ਹੋ ਰਿਹਾ ਪ੍ਰਸ਼ਨ ਕੀਦਾ ਵਿੱਚ ਤਾਂ ਜਿਹੜੀ ਮ ਬ ਐਲ ਈ ਡੀ ਕਿਹੜੀ ਕੰਪਨੀ ਦੀ ਹੈ ਸੈਮ ਕਿੰਨੀ ਇੰਚੀ ਆ ਪੰਦਰਾਂ ਇੰਚੀ ਆ ਹਾਂ ਪੰਦਰਾਂ ਇੰਚੀ ਹੋਊ ਸੋਲਾਂ ਦੀ ਤਾਂ ਆਉਂਦੀ ਨਹੀਂ ਪੰਦਰਾਂ ਹੀ ਆਉਂਦੀ ਆ ਪੰਦਰਾਂ ਇੰਚੀ ਹੋਊ ਅੱਛਾ ਸੈਮਸੰਗ ਦੀ ਕਿੰਨਾ ਟਾਈਮ ਹੋ ਗਿਆ ਕਿੰਨੀ ਪੁਰਾਣੀ ਹੈ ਇਹ ਤਾਂ ਵੀਰ ਜੀ ਪਤਾ ਕੀ ਹੈ ਗੱਲ ਪੰਦਰਾਂ ਇੰਚੀ ਸਕਰੀਨ ਹੈ ਪਹਿਲੀ ਗੱਲ ਤਾਂ ਆਪਾਂ ਨਾ ਰਿਪੇਅਰ ਇਹਦੀ ਸਕਰੀਨ ਸਕਰੀਨ ਰਿਪਲੇਸ ਹੀ ਹੁੰਦੀ ਹੁੰਦੀ ਹੈ ਮਤਲਬ ਇਹ ਚੇਂਜ ਕਰਨੀ ਪਊ ਹੁਣ ਜੇ ਪੰਦਰਾਂ ਸਾਲ ਪੁਰਾਣੀ ਹੈ ਸਕਰੀਨ ਇਹ ਐਂ ਮੰਨੋ ਵੀ ਬੜੇ ਘੱਟ ਚਾਂਸ ਨੇ ਸਕਰੀਨ ਦੇ ਮਤਲਬ ਇਹਦੇ ਅ ਰਿਪੇਅਰ ਤਾਂ ਹੋਣੀ ਨਹੀਂ ਨਵੀਂ ਹੁਣ ਸਤਾਰਾਂ ਇੰਚੀ ਪੰਦਰਾਂ ਇੰਚੀ ਤਾਂ ਨਹੀਂ ਮਿਲਣੀ ਸਤਾਰਾਂ ਇੰਚ ਸਕਰੀਨ ਆਉਂਦੀ ਹੈ ਇੱਕ ਵੱਡੀ ਆਉਂਦੀਆਂ ਨੇ ਅਤੇ ਸਤਾਰਾਂ ਇੰਚ ਸੈਮਸੰਗ ਦੀ ਐਲ ਜੀ ਦੀ ਆਉਂਦੀ ਹੈ ਏ ਓ ਸੀ ਖੇਤਰ ਦੀ ਆਉਂਦੀ ਹੈ ਅਲਗ ਅਲਗ ਵਾਰੰਟੀ ਗਰੰਟੀ ਆ ਜਿਵੇਂ ਆਪਾਂ ਸਤਾਰਾਂ ਇੰਚੀ ਜੇ ਮਤਲਬ ਐਲ ਜੀ ਦੀ ਸਕਰੀਨ ਲੈਣੀ ਹੈ ਤੁਸੀਂ ਸਤਾਰਾਂ ਇੰਚੀ ਐਲ ਜੀ ਦੀ ਸਕਰੀਨ ਹੈ ਤਾਂ ਉਹ ਇਹ ਮੰਨ ਲਓ ਬਈ ਤੁਹਾਨੂੰ ਪਚਾਨਵੇਂ ਸੌ ਦੀ ਮਿਲੂ ਜੇ ਸੈਮਸੰਗ ਦੀ ਲੈਣੀ ਹੈ ਉਹ ਦਸ ਹਜ਼ਾਰ ਦੀ ਹੈ ਜੇ ਤੁਸੀਂ ਏਸਰ ਦੀ ਲਓਂਗੇ ਥੋੜ੍ਹੀ ਸਸਤੀ ਬਣ ਜੂ ਉਹ ਸੱਤ ਇੱਕ ਸੌ ਪਚਾਸੀ ਸਤਾਸੀ ਦਾ ਉਹਦੀ ਉਹ ਰੇਟ ਮਤਲਬ ਡੇਲੀ ਦਾ ਹੁੰਦਾ ਉਦੋਂ ਤੱਕ ਕੱਲ੍ਹ ਨੂੰ ਵੀਹ ਪੰਜਾਹ ਇੱਧਰ ਉੱਧਰ ਹੋ ਜਾਣਾ ਅਤੇ ਜੇ ਵੱਡੀ ਲੈਣੀ ਹੈ ਸਕਰੀਨ ਪਰਪਜ ਕੀ ਆ ਤੁਸੀਂ ਕੈਮਰੇ ਲਾਏ ਹੋਏ ਨੇ ਜਾਂ ਕੰਪਿਊਟਰ 'ਚ ਇਕੱਲਾ ਯੂਜ਼ ਕਰਨਾ ਕੈਮਰੇ ਲੱਗੇ ਹੋਏ ਨੇ ਕੈਮਰੇ ਤੁਸੀਂ ਜੇ ਤੁਹਾਨੂੰ ਕਰਾਇਆ ਜਿਹੜੀ ਕੈਮਰੇ ਕਰਕੇ ਵੀ ਕਈ ਵਾਰੀ ਸਕਰੀਨ ਨੂੰ ਪ੍ਰੋਬਲਮ ਆਉਂਦੀ ਹੈ ਜੇ ਤੁਹਾਡੇ ਕੈਮਰੇ ਨੇ ਉਹਨੂੰ ਦੂਜੀ ਜਿਹੜੀ ਆਪਣੀ ਟੀ ਵੀ ਵਾਲੀ ਐਲ ਈ ਡੀ ਆਉਂਦੀ ਹੈ ਉਹ 'ਤੇ ਲਾਓ ਕੰਪਿਊਟਰ ਵਾਲੀ ਐਲ ਈ ਡੀ 'ਤੇ ਆਪਾਂ ਕੈਮਰਾ ਲਾ ਲੈਂਦੇ ਹਾਂ ਉਹ ਕਈ ਵਾਰੀ ਕੈਮਰਾ ਦੇ ਵਿੱਚ ਲਾਈਟ ਹੁੰਦੀ ਹੈ ਸਮਝੋ ਗੱਲ ਨੂੰ ਮਤਲਬ ਕਰੰਟ ਹੁੰਦਾ ਉਹ ਕਰੰਟ ਜਦੋਂ ਆਉਂਦਾ ਉਹ ਕਰੰਟ ਨਾਲ ਕਈ ਵਾਰੀ ਇਹਦਾ ਫ਼ਿਊਜ਼ ਫਿਆਜ ਉੱਡ ਜਾਂਦੇ ਨੇ ਮਤਲਬ ਉਹਦੇ ਨਾਲ ਪ੍ਰੋਬਲਮ ਆ ਜਾਂਦੀ ਹੈ ਆਪਾਂ ਨੂੰ ਇਹਦੇ ਵਿੱਚ ਸਕਰੀਨ ਦੇ ਵਿੱਚ ਛੋਟੀ ਸਤਾਰਾਂ ਇੰਚੀ ਲੈ ਲਓ ਪਚਾਨਵੇਂ ਕੁ ਸੌ ਦੀ ਐਲ ਜੀ ਦੀ ਫਿਰ ਆ ਜੂ ਐਲ ਜੀ ਦੀ ਵਧੀਆ ਸਾਲ ਦੀ ਵਰੰਟੀ ਹੈ ਅਤੇ ਇਹ ਜਿਹੜੀ ਹੈਗੀ ਆ ਇਹ ਰੱਖ ਜੋ ਕੋਈ ਪਾਰਟ ਕੋਈ ਚੇਂਜ ਹੋਇਆ ਸੌ ਦੋ ਸੌ ਰੁਪਈਆ ਕਿਹੜਾ ਹੈਗਾ ਤੁਸੀਂ ਵੇਚ ਕੇ ਉਹ ਦੁਕਾਨ 'ਤੇ ਫਿਰ ਤੁਸੀਂ ਅੱਜ ਮੈਂ ਬਾਹਰ ਹਾਂ ਕੱਲ੍ਹ ਨੂੰ ਲੈ ਆਓਂਗੇ ਕੱਕੱਲ ਨੂੰ ਨੂੰ ਸਵੇਰੇ ਦਸ ਕੁ ਵਜੇ ਆ ਜਾਇਓ ਹਾਂ ਕੋਈ ਸਕਰੀਨ ਇੱਕ ਵਾਰੀ ਲੈ ਆਇਓ ਆਪਾਂ ਦੇਖ ਲਵਾਂਗੇ ਨਹੀਂ ਤਾਂ ਫਿਰ ਨਵੀਂ ਦੇ ਦੇਵਾਂਗੇ ਓਕੇ ਜੀ ਓਕੇ ਆ ਜਾਇਓ